ਬਿਜਲੀ ਦੇ ਖ਼ਤਰੇ ਜਿਵੇਂ ਕਿ ਸ਼ੋਟ ਸਰਕਿਟ ਹੋ ਗਿਆ ਕਰੰਟ ਲੱਗਣਾ ਇਹਨਾਂ ਤੋਂ ਬੱਚਣ ਲਈ ਸਾਨੂੰ ਜਿਹੜੇ ਹੈ ਤਾਰਾਂ ਨੂੰ ਗਿੱਲੇ ਹੱਥ ਨਹੀਂ ਲਗਾਉਣੇ ਚਾਹੀਦੇ ਜਾਂ ਨੰਗੇ ਪੈਰ ਇਨ੍ਹਾਂ ਨੂੰ ਜਿਹੜਾ ਏ ਆਪਾਂ ਨੂੰ ਨਹੀਂ ਛੂਹਣਾ ਚਾਹੀਦਾ ਸ਼ੋਟ ਸਰਕਿਟ ਜਦੋਂ ਆਪਾਂ ਨੂੰ ਲੱਗਦਾ ਹੈ ਕਿ ਮੌਸਮ ਖ਼ਰਾਬ ਹੈ ਸਾਨੂੰ ਇਹਨਾਂ ਜੋ ਬਿਜਲੀ ਦੇ ਮੀਟਰ ਹੈ ਉਹਨਾਂ ਤੋਂ ਦੂਰ ਰਹਿਣਾ ਚਾਹੀਦਾ